ਵੈਸੇ ਤਾਂ ਅੱਜ ਕੱਲ੍ਹ ਦੇ ਲੋਕ ਕਾਫੀ ਤਰੀਕੇ ਦਾ ਡਾਂਸ ਸਿਖਦੇ ਨੇ ਪਰ ਕਾਫੀ ਜ਼ਿਆਦਾ ਲੋਕ ਸਾਡੇ ਖੇਤਰ ਦੇ ਵਿੱਚ ਪੰਜਾਬੀ ਭੰਗੜਾ ਸਿੱਖਣਾ ਪਸੰਦ ਕਰਦੇ ਨੇ ਪਰ ਭਾਰਤ ਦੇ ਵਿੱਚ ਡਾਂਸ ਦੀ ਕੋਈ ਕਮੀ ਨਹੀਂ ਇੱਥੇ ਬਹੁਤ ਸਾਰੇ ਡਾਂਸ ਨੇ ਜਿਵੇਂ ਕੱਥਕ ਹੋ ਗਿਆ ਭਰਤਨਾਟਿਅਮ ਹੋ ਗਿਆ ਕੁਚੀਪੁੜੀ ਹੋ ਗਿਆ ਪਰ ਅੱਜ ਕੱਲ੍ਹ ਲੋਕ ਵੈਸਟਰਨ ਡਾਂਸ ਨੂੰ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਵੈਸਟਰਨ ਡਾਂਸ ਦਾ ਮਤਲਬ ਇਹ ਹੈ ਕਿ ਜੋ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਜੋ ਡਾਂਸ ਵਗੈਰਾ ਸਿੱਖੇ ਜਾਂਦੇ ਨੇ ਉਹਨਾਂ ਡਾਂਸਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਾਫੀ ਸਾਰੇ ਲੋਕ ਸਿੱਖਦੇ ਨੇ ਸਪੈਸ਼ਲੀ ਕਾਫੀ ਸਾਰੇ ਲੋਕ ਅਕੈਡਮੀ ਜੋਇਨਸ ਕਰਦੇ ਨੇ ਕੋਈ ਕਲੱਬ ਵੀ ਜੁਆਇਨ ਕਰਦੇ ਨੇ ਜਿਹਦੇ ਨਾਲ ਉਹ ਡਾਂਸ ਸਿੱਖ ਸਕਣ ਜੇ ਮੈਂ ਗੱਲ ਕਰਾਂ ਤਾਂ ਡਾਂਸਰ ਬਣਨਾ ਕੋਈ ਮਾੜੀ ਗੱਲ ਨਹੀਂ ਹੈ ਡਾਂਸ ਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਆਪਣੇ ਸਰੀਰ ਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ ਡਾਂਸ ਵਿੱਚ ਖਾਸਕਰ ਲੋਕ ਜ਼ਿਆਦਾਤਰ ਵੈਸਟਰਨ ਅਤੇ ਪੰਜਾਬੀ ਭੰਗੜੇ ਨੂੰ ਪਸੰਦ ਕਰਦੇ ਨੇ ਕਾਫੀ ਲੋਕ ਬਥੇਰੇ ਹੋਰ ਵੀ ਤਰੀਕੇ ਦੇ ਡਾਂਸ ਸਿੱਖਣਾ ਪਸੰਦ ਕਰਦੇ ਨੇ ਡਾਂਸ ਦੀ ਭਾਰਤ ਦੇ ਵਿੱਚ ਵੈਸੇ ਕਮੀ ਕੋਈ ਨਹੀਂ ਅਤੇ ਸਿੱਖਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਡਾਂਸ ਕਰਨਾ ਸਾਰਿਆਂ ਨੂੰ ਬਹੁਤ ਪਸੰਦ ਹੈ ਡਾਂਸ ਹਰ ਕੋਈ ਕਰਦਾ ਹੈ ਹਰ ਕੋਈ ਆਪਣੇ ਲਈ ਕਰਦਾ ਹੈ ਆਪਣੇ ਖੁਸ਼ੀ ਨੂੰ ਜਤਾਉਣ ਲਈ ਡਾਂਸ ਕਰਦਾ ਹੈ ਡਾਂਸ ਕਰਨਾ ਹਮੇਸ਼ਾਂ ਇੱਕ ਵਧੀਆ ਕਲਾ ਹੈ ਜੇ ਕਿਸੇ ਕੋਲ ਕਲਾ ਹੈ ਤਾਂ ਉਹ ਬਹੁਤ ਹੀ ਵਧੀਆ ਬੰਦਾ ਹੈ ਕਿਉਂਕਿ ਉਹ ਹਮੇਸ਼ਾਂ ਤੰਦਰੁਸਤ ਰਹੇਗਾ ਡਾਂਸ ਕਰਨਾ ਇੱਕ ਬਹੁਤ ਵਧੀਆ ਗੱਲ ਹੈ ਪਰ ਇਹ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਡਾਂਸ ਨੂੰ ਸਾਨੂੰ ਲਗਾਤਾਰ ਹੀ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਸਾਨੂੰ ਬ੍ਰੇਕ ਲਾ ਦੇਣੀ ਚਾਹੀਦੀ ਹੈ ਜਾਂ ਸਾਨੂੰ ਛੱਡ ਦੇਣਾ ਚਾਹੀਦਾ ਡਾਂਸ ਡਾਂਸ ਆਪਣੇ ਮਜ਼ੇ ਲਈ ਕੀਤਾ ਜਾਂਦਾ ਹੈ ਇਸ ਲਈ ਸਾਨੂੰ ਡਾਂਸ ਕਰਨਾ ਕਦੇ ਵੀ ਛੱਡਣਾ ਨਹੀਂ ਚਾਹੀਦਾ